ਮੈਂ ਆਪਣੇ ਪਕਵਾਨਾਂ ਨੂੰ ਦੂਜਿਆਂ ਨੂੰ ਸਿਖਾਉਣ ਲਈ ਅਤੇ ਸੁਣਾਉਣ ਦੇ ਕਈ ਤਰੀਕੇ ਹਨ ਸਭ ਤੋਂ ਮੁੱਖ ਇਹ ਹੈ ਕਿ ਤੁਸੀਂ ਉਹਨਾਂ ਨੂੰ ਸਿਰਫ ਬਣਾਏ ਗਏ ਭੋਜਨ ਦਾ ਸੁਆਦ ਚਖਣ ਦਿਓ ਅਤੇ ਉਹਨਾਂ ਨੂੰ ਉਹ ਸ਼ਖਾਰਦਾ ਪ੍ਰਗਟ ਕਰਨ ਕਿ ਤੁਸੀਂ ਉਹਨਾਂ ਦੀ ਮਿਹਨਤ ਨੂੰ ਪਸੰਦ ਕਰਦੇ ਹੋ ਤੁਹਾਨੂੰ ਉਹਨਾਂ ਨੂੰ ਉਹਨਾਂ ਦੀ ਰੁਚੀ ਅਤੇ ਸੋਚ ਬਾਰੇ ਵੀ ਪੁੱਛਣ ਦੀ ਲੋੜ ਹੈ ਤਾਂ ਤਾਂ ਕਿ ਤੁਸੀਂ ਉਹਨਾਂ ਦੀ ਉਹਨਾਂ ਨੂੰ ਬਿਹਤਰ ਤੌਰ 'ਤੇ ਸਮਝ ਸਕੋ ਇਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਆਪਣੇ ਪਕਵਾਨਾਂ ਨੂੰ ਬਣਾਉਣ ਅਤੇ ਬਣਾਉਣ ਵਿੱਚ ਮਦਦ ਕਰਨ ਦੀ ਸਾਰੀ ਜਾਣਕਾਰੀ ਦਿਓ ਇਹ ਉਹਨਾਂ ਨੂੰ ਮੁਆਵਜ਼ਾ ਦੇਵੇਗਾ ਅਤੇ ਉਹਨਾਂ ਨੂੰ ਪਸੰਦ ਕਰਨ ਲਈ ਉਤੇਜਿਤ ਕਰੇਗਾ ਇੱਕ ਹੋਰ ਤਰੀਕਾ ਹੈ ਤੁਸੀਂ ਹੋਰਾਂ ਨਾਲ ਸੰਬੰਧ ਬਣਾਉਣ ਅਤੇ ਆਪਣੇ ਪਕਵਾਨਾਂ ਨੂੰ ਸਾਂਝਾ ਕਰਨ ਲਈ ਜਦੋਂ ਤੁਸੀਂ ਸਿਖਲਾਉਂਦੇ ਹੋ ਤਾਂ ਤੁਹਾਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਤੁਸੀਂ ਸਿਰਫ ਬਣਾਏ ਗਏ ਭੋਜਨ ਦਾ ਸਵਾਦ ਚਖਣ ਨਹੀਂ ਦਿਓ ਬਲਕਿ ਉਹਨਾਂ ਨੂੰ ਤੁਸੀਂ ਤੁਸੀਂ ਦੀਆਂ ਮਿਹਨਤਾਂ ਆਪਣੀ ਮਿਹਨਤਾਂ ਅਤੇ ਪਰਾਸੁਰਤਤੀ ਨੂੰ ਵੀ ਸ਼ੁੱਭ ਸਕਰਪਤਮ ਕਰਨ ਦਾ ਅਨੁਰੋਧ ਕਰੋ ਤੁਸੀਂ ਉਹਨਾਂ ਨੂੰ ਉਹਨਾਂ ਦੀ ਰੁਚੀ ਅਤੇ ਵਿਚਾਰ ਪੁੱਛ ਕੇ ਸਮਝ ਕੇ ਉਹਨਾਂ ਨੂੰ ਕਿਵੇਂ ਪਸੰਦ ਆਇਆ ਅਤੇ ਉਹਨਾਂ ਦੀ ਮਿਹਨਤ ਨੂੰ ਸਮਝ ਸਕਦੇ ਹੋ ਇਸ ਨਾਲ ਬਾਅਦ ਤੁਸੀਂ ਉਹਨਾਂ ਨੂੰ ਆਪਣੇ ਪਕਵਾਨਾਂ ਬਣਾਉਣ ਅਤੇ ਉਹਨਾਂ ਨੂੰ ਮਦਦ ਕਰਨ ਲਈ ਉਪਲਬਧ ਬਾਰੇ ਜਾਣਕਾਰੀ ਦਿਓ ਇਹ ਉਹਨਾਂ ਦਾ ਸਤਿਕਾਰ ਦੇਵੇਗਾ ਅਤੇ ਉਹਨਾਂ ਨੂੰ ਪਸੰਦ ਕਰਨ ਲਈ ਉਤੇਜਿਤ ਵੀ ਕਰੇਗਾ